ਅਕਸਰ ਪੌਦੇ ਜਿਹੜੇ ਹੁੰਦਿਆਂ ਨੇ ਸਭ ਤੋਂ ਪਹਿਲਾਂ ਤਾਂ ਅਸੀਂ ਗੱਲ ਕਰਨਾ ਚਾਹੁੰਦੇ ਹਾਂ ਪਾਣੀ ਦੀ ਪੌਦਿਆਂ ਨੂੰ ਜਿਹੜੀ ਪਾਣੀ ਦੀ ਜ਼ਰੂਰਤ ਹੈ ਉਹ ਗਰਮੀ ਦੇ ਵਿੱਚ ਜ਼ਿਆਦਾ ਹੁੰਦੀ ਹੈ ਅਤੇ ਸਰਦੀ ਦੇ ਵਿੱਚ ਘੱਟ ਹੁੰਦੀ ਹੈ ਇਸ ਲਈ ਵੱਖ ਵੱਖ ਜਿਹੜੇ ਅਸੀਂ ਕਹਿ ਸਕਦੇ ਹਾਂ ਕਿ ਮੌਸਮ ਦੇ ਅਧਾਰ 'ਤੇ ਉਹਨੂੰ ਪਾਣੀ ਦੇਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਤਾਂ ਜਿਹੜੇ ਗਰਮੀ ਦੇ ਵਿੱਚ ਪਾਣੀ ਹੈ ਉਹਨੂੰ ਰੋਜ਼ ਰੋਜ਼ ਹੀ ਸਾਨੂੰ ਪੌਦਿਆਂ ਨੂੰ ਪਾਣੀ ਦੇਣਾ ਪੈਂਦਾ ਹੈ ਅਤੇ ਗਰਮ ਸਰਦੀ ਹੋ ਗਈ ਸਰਦੀ ਦੇ ਵਿੱਚ ਸਾਨੂੰ ਡੇਲੀ ਹਰ ਰੋਜ਼ ਪੌਦਿਆਂ ਨੂੰ ਪਾਣੀ ਨਹੀਂ ਦੇਣਾ ਚਾਹੀਦਾ ਕਿਉਂਕਿ ਪੌਦਿਆਂ ਨੂੰ ਜ਼ਿਆਦਾ ਪਾਣੀ ਦੇਣ ਨਾਲ ਪਹਿਲਾਂ ਹੀ ਸਾਡੇ ਉਹ ਠੰਡ ਦੇ ਵਿੱਚ ਇੰਨੀ ਜ਼ਿਆਦਾ ਨਮੀ ਹੁੰਦੀ ਹੈ ਜ਼ਮੀਨ ਕਿ ਉਹਨਾਂ ਨੂੰ ਪਾਣੀ ਦੇਣ ਦੀ ਤਾਂ ਜ਼ਰੂਰਤ ਹੀ ਨਹੀਂ ਪੈਂਦੀ ਜੇ ਜ਼ਿਆਦਾ ਪਾਣੀ ਦੇਵਾਂਗੇ ਉਹ ਵੀ ਪੌਦਿਆਂ ਦੀ ਖਰਾਬ ਕਰਦਾ ਉਸ ਤੋਂ ਬਾਅਦ ਅਸੀਂ ਗੱਲ ਕਰਨਾ ਚਾਹੁੰਦੇ ਹਾਂ ਖਾਦ ਖਾਦ ਹਰ ਮੌਸਮ ਦੇ ਅਲੱਗ ਅਲੱਗ ਪੌਦੇ ਹੁੰਦੇ ਹਨ ਵੱਖਰੇ ਵੱਖਰੇ ਪੌਦੇ ਹੁੰਦੇ ਹਨ ਕਿ ਕੋਈ ਪੌਦਾ ਜਿਹੜਾ ਉਹ ਸਰਦੀ ਦਾ ਉਹ ਸਰਦੀ 'ਚ ਹੁੰਦਾ ਗਰਮੀਆਂ ਦਾ ਪੌਦਾ ਉਹ ਗਰਮੀ 'ਚ ਹੁੰਦਾ ਇਸੇ ਤਰ੍ਹਾਂ ਖਾਦਾਂ ਹੁੰਦੀਆਂ ਨੇ ਜਿਹੜੀਆਂ ਸਰਦੀਆਂ ਦੇ ਵਿੱਚ ਜਿਹੜੇ ਪੌਦੇ ਹੁੰਦੇ ਨੇ ਉਹਦੇ ਅਕੋਰਡਿੰਗਲੀ ਹੀ ਅਸੀਂ ਉਹਨਾਂ ਨੂੰ ਖਾਦ ਪਾਉਂਦੇ ਹਾਂ ਮੇਨ ਗੱਲ ਤਾਂ ਜੇ ਅਸੀਂ ਕਰੀਏ ਤਾਂ ਅਸੀਂ ਬਚਾਉਣ ਲਈ ਪਾਣੀ ਪਾਣੀ ਕਹਿੰਦੇ ਆ ਪੌਦੇ ਨੂੰ ਜੀਵਨ ਵੀ ਦਿੰਦਾ ਅਤੇ ਮਾਰ ਵੀ ਦਿੰਦਾ ਇਸ ਕਰਕੇ ਪਾਣੀ ਦਾ ਬੜਾ ਖਾਸ ਧਿਆਨ ਰੱਖਣਾ ਪੈਂਦਾ ਜੋ ਅਸੀਂ ਸਰਦੀ ਗਰਮੀ ਬਹੁਤ ਹੀ ਸਹੀ ਤਰੀਕੇ ਨਾਲ ਉਸਨੂੰ ਯੂਜ ਕਰਦੇ ਆਪਣੇ ਪੌਦਿਆਂ ਨੂੰ ਬਚਾਉਣ ਲਈ